ਪਟਿਆਲੇ ਜ਼ਿਲ੍ਹੇ ਵਿੱਚ ਜੋ ਵਾਤਾਵਰਨ ਸੰਬੰਧੀ ਚੁਣੌਤੀ ਹਨ ਉਹ ਬੇਹੱਦ ਸੰਕਟਮਈ ਹਨ ਪਾਣੀ ਦਾ ਮੁੱਖ ਸਰੋਤ ਧਰਤੀ ਹੇਠਲਾ ਪਾਣੀ ਹੈ ਜੋ ਦਿਨੋ ਦਿਨ ਲਗਾਤਾਰ ਨੀਚੇ ਡਿੱਗਦਾ ਜਾ ਰਿਹਾ ਹੈ ਸਰਕਾਰਾਂ ਦਾ ਵੱਲੋਂ ਫਸਲਾਂ ਦਾ ਵਿਭਿੰਨ ਫਸਲੀ ਚੱਕਰ ਨਾ ਅਪਣਾਉਣ ਕਾਰਨ ਅਤੇ ਕੱਲੇ ਝੋਨੇ ਨੂੰ ਹੀ ਐਂ ਐੱਮ ਐੱਸ ਪੀ ਵਿੱਚ ਰੱਖਣ ਕਾਰਨ ਇਲਾਕੇ ਦੇ ਜੋ ਕਿਸਾਨ ਹਨ ਉਹ ਝੋਨਾ ਬੀਜਣ ਲਈ ਮਜਬੂਰ ਹਨ ਜਿਸ ਕਾਰਨ ਪਾਣੀ ਦਾ ਲੈਵਲ ਧਰਤੀ ਵਿੱਚੋਂ ਹੇਠਾਂ ਹੁੰਦਾ ਜਾ ਰਿਹਾ ਹੈ ਦੂਸਰੇ ਪੱਖ ਤੋਂ ਨਗਰਪਾਲਿਕਾ ਵੱਲੋਂ ਜਿਹੜੀ ਕੂੜੇ ਦੇ ਸਫ਼ਾਈ ਵਾਲੀ ਗੱਲ ਹੈ ਤਾਂ ਕੂੜੇ ਦੇ ਢੇਰ ਆਮ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਹਨ ਕਿਤੇ ਕਿਤੇ ਕੁਝ ਕੂੜੇ ਦੇ ਢੇਰ ਹਟਾਏ ਜਾਂਦੇ ਹਨ ਪਰ ਬਹੁਤੀ ਥਾਈਂ ਕੂੜਾ ਹੈ ਜਿਹੜਾ ਉਹ ਸੜਕਾਂ ਦੇ ਉੱਤੇ ਖਿਲਰਿਆ ਹੋਇਆ ਜਾਂ ਕਿਧਰੇ ਹੋਰ ਗਲੀਆਂ 'ਚ ਨਾਲੀਆਂ ਦੇ ਵਿੱਚ ਫਸਿਆ ਦਿਖ ਜਾਂਦਾ ਹੈ ਜਦੋਂ ਬਾਰਿਸ਼ ਆਉਂਦੀ ਹੈ ਤਾਂ ਗਟਰ ਸਾਫ਼ ਨਾ ਹੋਣ ਕਾਰਨ ਸੀਵਰੇਜ ਦੀ ਸਪਲਾਈ ਨਾ ਹੋਣ ਕਾਰਨ ਸਾਰੇ ਪਟਿਆਲੇ ਦੇ ਵਿੱਚ ਆਮ ਹੀ ਪਾਣੀ ਭਰ ਜਾਂਦਾ ਹੈ ਪਿਛਲੇ ਦਿਨੀਂ ਵੀ ਹੜ੍ਹ ਆਉਣ ਦੇ ਕਾਰਨ ਪਟਿਆਲੇ ਦੇ ਵਿੱਚ ਪਾਣੀ ਭਰ ਗਿਆ ਸੀ